ਭੰਗੜਾ ਅਰਬੀ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਦਾ ਇੱਕ ਤਰੀਕਾ ਹੈ ਜੋ ਇਸ ਪ੍ਰਕਾਰ ਹੈ ਭੰਗੜਾ ਇੱਕ ਪ੍ਰਸਿੱਧ ਪੰਜਾਬੀ ਨਾਚ ਹੈ ਜੋ ਪੰਜਾਬ ਦੇ ਸੱਭਿਆਚਾਰ ਦਾ ਇਕ ਅਹਿਮ ਹਿੱਸਾ ਹੈ ਅਰਬੀ ਵਿੱਚ ਭੰਗੜੇ ਨੂੰ ਅਲ ਪੰਜਰਾ ਕਿਹਾ ਜਾਂਦਾ ਹੈ ਪੰਜਾਬ ਦੇ ਸੱਭਿਆਚਾਰ ਨੂੰ ਅਰਬੀ ਵਿਚ ਦਿਖਾਉਣ ਲਈ ਭੰਗੜੇ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਅਰਬੀ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਵਾਲੇ ਇਹ ਕੁਝ ਸ਼ਬਦ ਸ਼ਾਮਿਲ ਹਨ ਪੰਜਾਬ ਅਲ ਤਪਸਾ ਅਲ ਪੰਜਾਬੀਆ ਪੰਜਾਬੀ ਸੱਭਿਆਚਾਰ ਪੰਜਾਬ ਦਾ ਅਲਤੁਰਭ ਅਲ ਪੰਜਾਬੀ ਵਿਰਾਸਤ ਅਲ ਰਤਸ ਅਲ ਪੰਜਾਬੀ ਪੰਜਾਬੀ ਨਾਚ ਭੰਗੜਾ ਸ਼ਾਮਿਲ ਹੈ ਅਰਬੀ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਵਾਲੇ ਕੁਝ ਵਾਕਾਂ ਵਿੱਚ ਸ਼ਾਮਿਲ ਹਨ ਅਲ ਪੰਜਾਬੀਆ ਫਤਾ ਫਾ ਪੰਜਾਬੀ ਸੱਭਿਆਚਾਰ ਅਮੀਰ ਹੈ ਪੰਜਾਬ ਦਾ ਸੱਭਿਆਚਾਰ ਬਹੁਤ ਹੀ ਧਨੀ ਹੈ ਪੰਜਾਬੀ ਵਿਰਸੇ ਨੂੰ ਨਾਚ ਅਤੇ ਸੰਗੀਤ ਨਾਲ ਮਿਲਾਇਆ ਗਿਆ ਹੈ